ਟੈਕਨੋਲੋਜੀ ਨੇ ਸਾਡੇ ਰੁਜ਼ਗਾਰ ਜੀਵਨ ਵਿੱਚ ਕਾਫੀ ਬਦਲਾਅ ਲਾ ਅਤੇ ਨੇ ਇਸੇ ਤਰੀਕੇ ਨਾਲ ਇਹ ਹੁਣ ਅੱਜ ਦੇ ਸਮੇਂ ਵਿੱਚ ਡਾਕਟਰੀ ਸੇਵਾਵਾਂ ਵੀ ਸਾਨੂੰ ਕਿਤੇ ਨਾ ਕਿਤੇ ਬਹੁਤ ਵਧੀਆ ਦੇ ਰਹੇ ਨੇ ਕਿਉਂਕਿ ਜੇ ਟੈਕਨੋਲੋਜੀ ਹੈ ਇਹਦੇ ਕਰਕੇ ਆਪਾਂ ਕਿਸੇ ਵੀ ਦੇਸ਼ ਦੇ ਵਿੱਚ ਬੈਠੇ ਹੋਏ ਡਾਕਟਰ ਜਾਂ ਉਸ ਚੀਜ਼ ਉਸ ਬਿਮਾਰੀ ਦਾ ਮਾਹਰ ਬੰਦਾ ਹੈ ਜਾਂ ਡਾਕਟਰ ਹੈ ਉਹਨੂੰ ਆਪਾਂ ਅ ਕੋਂਟੈਕਟ ਕਰ ਸਕਦੇ ਹਾਂ ਜਿਹਦੇ ਵਿੱਚ ਉਹ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਕਹਿ ਲਓ ਕਿ ਸੁਝਾਵਾਂ ਦਿੰਨੇ ਨੇ ਵੱਖਰੇ ਵੱਖਰੇ ਢੰਗ ਦੇ ਸਾਨੂੰ ਕਸਰਤ ਕਰਨ ਦਾ ਸੁਝਾਅ ਦਿੰਦੇ ਆ ਅਤੇ ਜੇ ਕੋਈ ਦਵਾਈ ਵੀ ਹੋਵੇ ਤਾਂ ਅਸੀਂ ਉਹਨੂੰ ਔਨਲਾਈਨ ਤੌਰ ਦੇ ਵਿੱਚ ਮੰਗਾ ਸਕਦੇ ਹਾਂ ਅਤੇ ਔਨਲਾਈਨ ਦਾ ਸਾਨੂੰ ਇਹ ਵੀ ਵਾਧਾ ਹੈ ਵੀ ਕਿ ਆਪਾਂ ਲੋਕਾਂ ਦੇ ਜਿਹੜੇ ਉਹ ਸਹੀ ਹੋਏ ਮਰੀਜ਼ ਦੇ ਡਾਕਟਰ ਦੇ ਉਹਨਾਂ ਨੂੰ ਸੁਣ ਸਕਦੇ ਹਾਂ ਉਹਨਾਂ ਦੇ ਜਿਹੜਾ ਤਜਰਬਾ ਹੈ ਉਹਨਾਂ ਨੂੰ ਉਹ ਸਾਂਝਾ ਕਰਦੇ ਆ ਜਿਹਨਾਂ ਨੂੰ ਦੇਖ ਕੇ ਲੱਗਦਾ ਕਿ ਨਹੀਂ ਇਹ ਸਹੀ ਹੋ ਰਿਹਾ ਇਲਾਜ ਤਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਜੇ ਟੈਕਨੋਲੋਜੀ ਆ ਇਹਨੇ ਬਾਕੀ ਖੇਤਰ ਦੇ ਹਿਸਾਬ ਦੇ ਨਾਲ ਨਾਲ ਦਵਾਈ ਦੇ ਇਸ ਖੇਤਰ ਵਿੱਚ ਡਾਕਟਰੀ ਸੇਵਾਵਾਂ ਦੇ ਵਿੱਚ ਵੀ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਜਿਸ ਕਰਕੇ ਆਉਣ ਵਾਲਾ ਸਮਾਂ ਇਵੇਂ ਦਾ ਹੋਵੇਗਾ ਕਿ ਸ਼ਾਇਦ ਲੋਕਾਂ ਨੂੰ ਡਾਕਟਰ ਤੱਕ ਜਾਣ ਦੀ ਲੋੜ ਵੀ ਨਾ ਪਵੇ ਉਹ ਉੱਥੋਂ ਘਰੋਂ ਬੈਠਿਆ ਹੀ ਦੱਸ ਦੇਵੇ ਕਿ ਉਹਨੂੰ ਕੀ ਕਰਨਾ ਚਾਹੀਦਾ ਹੈ ਹਜੇ ਤਾਂ ਫਿਲਹਾਲ ਚਲੋ ਇਹ ਹੈ ਵੀ ਕਿ ਦਵਾਈ ਦਾ ਹੋਰ ਵੀ ਦੇ ਰਿਹਾ ਇਸ ਤਰੀਕੇ ਦੇ ਨਾਲ ਪਰ ਆਉਣ ਵਾਲਾ ਸਮਾਂ ਸ਼ਾਇਦ ਇੱਦਾਂ ਵੀ ਕੁਛ ਹੋ ਜਾਵੇ ਕਿ ਜਿਵੇਂ ਆਪਾਂ ਦੇਖ ਰਹੇ ਟੈਕਲੋਲੋਜੀ ਬਹੁਤ ਜ਼ਿਆਦਾ ਤਰੱਕੀਆਂ ਕਰ ਲਈਆਂ ਹੋਈਆਂ ਅਤੇ ਇਹ ਕੋਈ ਰੋਬੋਟ ਹੀ ਛੱਡ ਦੇਣ ਵੀ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਇੱਕ ਦੋ ਰੋਬੋਟ ਛੱਡ ਦੇਣ ਕਿ ਉਹ ਉੱਥੇ ਬੈਠੇ ਹੀ ਉਹ ਰੋਬੋਟ ਨੂੰ ਸਲਾਹਾਂ ਦੇਣ ਅਤੇ ਉਥੋਂ ਹੀ ਉਹਨਾਂ ਦਾ ਦਵਾਈ ਪਾਣੀ ਅਤੇ ਉਹਨਾਂ ਦਾ ਆਪਰੇਸ਼ਨ ਜੋ ਵੀ ਕਰਨਾ ਹੋਇਆ ਉਹ ਰੋਬੋਟ ਵੀ ਕਰ ਦੇਵੇ ਅਤੇ ਇਹ ਲਗਾਤਾਰ ਵੱਧਦਾ ਜਾ ਰਿਹਾ ਇਹ ਜਿਹੜਾ ਟੈਕਨੋਲਜੀ ਦਾ ਯੁੱਗ ਹੈ ਅਤੇ ਇਹਦੇ ਕਰਕੇ ਸਾਰੇ ਮਰੀਜ਼ਾਂ ਨੂੰ ਜਾਂ ਉਹ ਲੋਕਾਂ ਨੂੰ ਬਹੁਤ ਵਾਧਾ ਮਿਲਦਾ ਜਿਹੜੇ ਕਿ ਬਹੁਤ ਜ਼ਿਆਦਾ ਬੀਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਤੇ ਆਪਣੇ ਸਮਾਂ ਕਰਨਾ ਬਹੁਤ ਔਖਾ ਹੈ ਪਰ ਇਹ ਉਹ ਇਲਾਜ ਕਰਕੇ ਉਹਨਾਂ ਨੇ ਸੌਖਾ ਹੋ ਗਿਆ